ਮੈਂ ਅਪ ਮੈਂ ਅਤੇ ਆਪਣੇ ਪਰਿਵਾਰ ਦੇ ਨਾਲ ਦਿਵਾਲੀ ਦਾ ਤਿਉਹਾਰ ਬਹੁਤ ਹੀ ਚਾਅਵਾਂ ਨਾਲ ਮਨਾਉਂਦੇ ਹਾਂ ਇਸ ਦਿਨ ਅਸੀਂ ਸਵੇਰ ਤੋਂ ਹੀ ਆਪਣੇ ਘਰ ਦੀ ਸਫਾਈ ਅਤੇ ਸਜਾਵਟ ਕਰਨੀ ਸ਼ੁਰੂ ਕਰ ਦਿੰਦੇ ਹਾਂ ਫਿਰ ਅਸੀਂ ਨਹਾ ਧੋ ਕੇ ਮੰਦਰ ਜਾਂਦੇ ਹਾਂ ਪਰਿਵਾਰ ਸਮੇਤ ਅਤੇ ਆਪਣੇ ਰਿਸ਼ਤੇਦਾਰਾਂ ਦੇ ਘਰ ਵੀ ਉਹਨਾਂ ਨੂੰ ਤੋਹਫੇ ਦੇਣ ਲਈ ਜਾਂਦੇ ਹਾਂ ਇਸ ਦਿਨ ਅਸੀਂ ਆਪਣੇ ਘਰ ਵਿੱਚ ਬਹੁਤ ਹੀ ਸਾਰੀਆਂ ਮਿਠਾਈਆਂ ਜਿਵੇਂ ਕਿ ਜਲੇਬੀ ਗੁਲਾਬ ਜਾਮੁਨ ਰਸਗੁੱਲੇ ਚਮਚਮ ਆਦਿ ਬਣਾਉਂਦੇ ਹਾਂ ਜਾਂ ਫਿਰ ਬਜ਼ਾਰ ਤੋਂ ਵੀ ਮੰਗਵਾ ਲੈਂਦੇ ਹਾਂ ਇਸ ਦਿਨ ਆਪਾਂ ਬਹੁਤ ਹੀ ਚਾਅਵਾਂ ਦੇ ਨਾਲ ਰਾਤ ਨੂੰ ਸਰ੍ਹੋਂ ਦੇ ਤੇਲ ਦੇ ਦੀਵੇ ਆਪਣੇ ਘਰ ਦੀਆਂ ਛੱਤਾਂ ਦੇ ਆਲੇ ਦੁਆਲੇ ਪੂਰੀ ਰੌਣਕ ਲਗਾਉਂਦੇ ਹਾਂ ਅਤੇ ਉਸ ਦੀ ਜਗਮਗਾਹਟ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ